ਮੇਰੇ ਘਰ ਵਿੱਚ ਮੇਰੇ ਮਾਤਾ ਜੀ ਬਿਮਾਰ ਹਨ ਉਹਨਾਂ ਨੂੰ ਬੁਖ਼ਾਰ ਰਹਿੰਦਾ ਹੈ ਅਤੇ ਉਹਨਾਂ ਦਾ ਪੇਟ ਵੀ ਖ਼ਰਾਬ ਹੈ ਸੋ ਉਹਨਾਂ ਲਈ ਘਰ ਵਿੱਚ ਮੈਂ ਪਤਲੀ ਖਿਚੜੀ ਨਮਕ ਵਾਲੀ ਅਤੇ ਉਹਨਾਂ ਲਈ ਨਮਕੀਨ ਦਲੀਆ ਬਣਾਉਂਦੀ ਹਾਂ ਜੋ ਕਿ ਉਹਨਾਂ ਦੇ ਹਾਜ਼ਮੇ ਲਈ ਹੈ ਅਤੇ ਬੁਖ਼ਾਰ ਵਿੱਚ ਉਹਨਾਂ ਲਈ ਇਹ ਖਾਣਾ ਠੀਕ ਹੈ ਅਤੇ ਇਹ ਖਾਣਾ ਉਹਨਾਂ ਨੂੰ ਜਲਦੀ ਹਜ਼ਮ ਵੀ ਹੁੰਦਾ ਹੈ